ਰਸਾਲਾ ਅਖ਼ਬਾਰ ਅਤੇ ਬਲੌਗ ਇਹਨਾਂ ਤਿੰਨਾਂ ਵਿੱਚੋਂ ਜੋ ਅਖ਼ਬਾਰ ਹੈ ਉ ਮੈਨੂੰ ਬਹੁਤ ਹੀ ਮੇਰੀ ਮਨਪਸੰਦ ਹੈ ਕਿਉਂਕਿ ਅਖ਼ਬਾਰ ਵਿੱਚ ਅਜੀਤ ਅਖ਼ਬਾਰ ਅਜੀਤ ਅਖ਼ਬਾਰ ਵਿੱਚ ਬਹੁਤ ਹੀ ਵਧੀਆ ਮਤਲਬ ਐਡਵਰਟਾਈਜਮੈਂਟ ਆਉਂਦੀਆਂ ਹਨ ਜਿਸਦੇ ਵਿੱਚ ਕਿ ਸ ਮਤਲਬ ਐਜੂਕੇਸ਼ਨ ਨਾਲ ਸੰਬੰਧਿਤ ਸਾਡੀ ਹੈਲਥ ਨਾਲ ਸੰਬੰਧਿਤ ਹੈਲਥ ਰਿਗਾਰਡਿੰਗ ਅਗਰ ਜਿਵੇਂ ਕਹਿ ਸਕਦੇ ਅਸੀਂ ਮਾਨਸਿਕ ਜਿਵੇਂ ਕਿ ਜੋ ਵੀ ਮਾਨਸਿਕ ਰਿਲੇਟਡ ਜੋ ਵੀ ਆ ਸਾਡੀ ਸਿਚੁਏਸ਼ਨ ਅਗਰ ਨਹੀਂ ਹੈਂਡਲ ਕਰ ਪਾ ਰਹੇ ਉਸ ਦੇ ਨਾਲ ਰਿਲੇਟਡ ਸਾਨੂੰ ਬਹੁਤ ਸਾਰੀਆਂ ਇੱਦਾਂ ਦੀਆਂ ਐਡਵਰਟਾਈਜਮੈਂਟ ਦੱਸੀਆਂ ਜਾਂਦੀਆਂ ਹਨ ਬਹੁਤ ਹੀ ਇੱਦਾਂ ਦੀਆਂ ਮੋਟੀਵੇਸ਼ਨਲ ਚੀਜ਼ਾਂ ਦੱਸੀਆਂ ਜਾਂਦੀਆਂ ਹਨ ਜਿਸ ਦੇ ਨਾਲ ਕਿ ਅਸੀਂ ਮਤਲਬ ਆਪਣੇ ਆਪ ਨੂੰ ਮੋਟੀਵੇਟ ਰੱਖ ਸਕੀਏ ਅਤੇ ਉਸਦੇ ਨਾਲ ਹੀ ਜੋ ਵੀ ਦਿਨ ਦਿਹਾੜੇ ਜੋ ਵੀ ਚੱਲ ਰਿਹਾ ਹੈ ਦੁਨੀਆਂ ਵਿੱਚ ਉਹ ਸਾਰਾ ਕੁਛ ਪਤਾ ਚੱਲਦਾ ਹੈ ਅਤੇ ਬਾਕੀ ਹੋਰ ਜਿਵੇਂ ਕਿਸੇ ਨੂੰ ਜੋ ਕਿਸੇ ਨੂੰ ਕਿਸੇ ਕਿਸੇ ਕੰਮ ਸਬੰਧੀ ਜਾਂ ਕੋਈ ਵੀ ਕਿਸੇ ਵੀ ਰਿਗਾਰਡਿੰਗ ਅਗਰ ਕੋਈ ਹੈ ਕਿਸੇ ਵੀ ਚੀਜ਼ ਦੀ ਇਸ਼ੂ ਉਸ ਉਸ ਨਾਲ ਸੰਬੰਧਿਤ ਜੋ ਹੈ ਇਹ ਸਾਰੇ ਨਿਊਜ਼ ਜਾਂ ਮਤਲਬ ਜੋ ਵੀ ਸਾਨੂੰ ਸਲਾਹ ਕਿਸੇ ਵੀ ਪ੍ਰੋਬਲਮ ਨੂੰ ਲੈ ਕੇ ਜੋ ਵੀ ਸਲਾਹ ਦਿੱਤੀ ਜਾਂਦੀ ਹੈ ਉਹ ਸਾਨੂੰ ਨਿਊਜ਼ ਪੇਪਰ ਅਖ਼ਬਾਰ ਦੇ ਰਾਹੀਂ ਮਤਲਬ ਮਿਲਦੀ ਹੈ ਇਸ ਕਰਕੇ ਅਖ਼ਬਾਰ ਪੜ੍ਹਨਾ ਮੈਨੂੰ ਬਹੁਤ ਵਧੀਆ ਲੱਗਦਾ ਹੈ